ਹੈਲੋ ਗੁਡ ਈਵਨਿੰਗ ਹਾਂਜੀ ਹਾਂਜੀ ਮੈਡਮ ਹਾਂਜੀ ਦੱਸੋ ਹਾਂਜੀ ਮੈਮ ਦੱਸੋ ਜੀ ਹਾਂਜੀ ਮੈਡਮ ਓਕੇ ਮੈਮ ਓਕੇ ਮੈਮ ਕੋਈ ਗੱਲ ਨਹੀਂ ਮੈਮ ਹਾਂਜੀ ਮੇਰੀ ਨਾ ਮੈਨੇਜਮੈਂਟ ਨਾਲ ਗੱਲ ਚੱਲ ਰਹੀ ਆ ਇਸ ਬਾਰੇ 'ਚ ਤਾਂ ਆਪਾਂ ਮੈਡਮ ਜਲਦੀ ਹਾਂਜੀ ਕਰਾਂਗੇ ਇਸ ਵਾਸਤੇ ਸਲਿਊਸ਼ਨ ਲੱਭਾਂਗੇ ਇਹਦਾ ਹਾਂਜੀ ਹਾਂਜੀ ਮੈਡਮ ਕੋਈ ਗੱਲ ਨਹੀਂ ਬਸ ਤੁਸੀਂ ਨਾ ਥੋੜ੍ਹਾ ਜਿਹਾ ਕੋਪਰੇਟ ਕਰੋ ਬੱਚਿਆਂ ਦਾ ਨੁਕਸਾਨ ਵੀ ਨਹੀਂ ਦੇਖੋ ਹੋਣਾ ਚਾਹੀਦਾ ਹਾਂਜੀ ਹਾਂਜੀ ਮੈਡਮ ਹਾਂਜੀ ਮੈਡਮ ਕੋ ਹਾਂਜੀ ਹਾਂਜੀ ਮੈਡਮ ਨਹੀਂ ਕੋਈ ਗੱਲ ਨਹੀਂ ਮੈਡਮ ਆਪਾਂ ਜਲਦੀ ਕਰਵਾਵਾਂਗੇ ਪ੍ਰੋਬਲਮ ਠੀਕ ਆ ਹਾਂਜੀ ਹਾਂਜੀ ਮੈਡਮ ਹਾਂਜੀ ਮੈਡਮ ਕੋਈ ਹਾਂਜੀ ਅਤੇ ਕਿਸੇ ਹੋਰ ਕਲਾਸ ਦੇ ਵਿੱਚ ਤਾਂ ਨਹੀਂ ਮੈਡਮ ਸੇਮ ਪ੍ਰੋਬਲਮ ਅੱਛਾ ਜੀ ਹਾਂਜੀ ਮੈਡਮ ਫਿਰ ਮੈਨੂੰ ਐਂ ਨਾ ਜੇ ਪਤਾ ਲੱਗ ਜੂਗਾ ਵੀ ਹੋਰ ਵੀ ਕਿਸੇ ਫਿਰ ਆਪਾਂ ਉਸ ਤਰੀਕੇ ਨਾਲ ਗੱਲ ਕਰ ਲਵਾਂਗੇ ਵੀ ਜਲਦੀ ਕੀਤਾ ਜਾਵੇ ਪ੍ਰੋਬਲਮ ਦਾ ਹੱਲ ਹਾਂਜੀ ਨਹੀਂ ਕੋਈ ਗੱਲ ਨਹੀਂ ਮੈਮ ਠੀਕ ਹੈ ਜੀ ਹਾਂਜੀ ਕਰਾਂਗੇ ਆਪਾਂ ਹੱਲ ਇਹਦਾ ਜਲਦੀ ਤੋਂ ਜਲਦੀ ਓਕੇ ਮੈਮ ਓਕੇ ਓਕੇ